ਪੰਜਾਬੀ ਨੇਮ ਅਮਨਦੀਪ ਸਿੰਘ ਅੰਮ੍ਰਿਤਪਾਲ ਸਿੰਘ ਅਰਜਨ ਸਿੰਘ ਬਲਜੋਤ ਸਿੰਘ ਗੁਰਦੀਪ ਸਿੰਘ ਗੁਰਕੀਰਤ ਸਿੰਘ ਗੁਰਪ੍ਰੀਤ ਸਿੰਘ ਹਰਜੋਤ ਸਿੰਘ ਬੜੈਂਚ ਹਰਪ੍ਰੀਤ ਸਿੰਘ ਗਿੱਲ ਜਸਪ੍ਰੀਤ ਸਿੰਘ ਗਰੇਵਾਲ ਕਰਨ ਭੱਲਾ ਕਿਰਨਦੀਪ ਸਿੰਘ ਰਾਏ ਕਿਰਪਾਲ ਸਿੰਘ ਮਨਦੀਪ ਸਿੰਘ ਮਹਿੰਦਰ ਪਾਲ ਸਿੰਘ ਨਵਜੋਤ ਸਿੰਘ ਸਿੱਧੂ ਪਰਗਟ ਸਿੰਘ ਸੰਧੂ ਪ੍ਰੀਤ ਇੰਦਰ ਸਿੰਘ ਜੌਹਲ ਰਣਜੀਤ ਸਿੰਘ ਸੰਦੀਪ ਸਿੰਘ ਸਿਮਰਨਜੀਤ ਸਿੰਘ ਮਰਵਾਹਾ ਸੁਖਵਿੰਦਰ ਸਿੰਘ ਤਜਿੰਦਰ ਸਿੰਘ ਉਦੈਵੀਰ ਸਿੰਘ ਰਾਠੌਰ ਜੋਰਾਵਰ ਸਿੰਘ ਗੁਰਦੀਪ ਸਿੰਘ ਗੁਰਮੁਖ ਸਿੰਘ ਜੰਜੀਰ ਸਿੰਘ ਜਾਫਰ ਅਲੀ ਸਿੰਘ ਜੁਲਫਕਾਰ ਸਿੰਘ